ਡਾਂਸ ਸਿਰਫ ਆਰਟ ਅਤੇ ਜਾਹਰ ਕਰਨ ਲਈ ਨਹੀਂ ਹੁੰਦਾ ਬਲਕਿ ਸੰਚਾਰ ਤੰਦਰੁਸਤੀ ਅਤੇ ਸਿੱਖਣ ਲਈ ਇੱਕ ਤਾਕਤਵਰ ਹਥਿਆਰ ਹੈ ਜਦੋਂ ਅਸੀਂ ਨੱਚਦੇ ਹਾਂ ਸਾਡਾ ਪੂਰਾ ਸਰੀਰ ਅਤੇ ਦਿਮਾਗ ਸਰਗਰਮ ਹੁੰਦਾ ਹੈ ਸਾਡਾ ਤਾਲਮੇਲ ਵਧੀਆ ਹੁੰਦਾ ਹੈ ਡਾਂਸ ਦੀਆਂ ਅਲੱਗ ਅਲੱਗ ਪ੍ਰਕਾਰ ਹੁੰਦੀਆਂ ਹਨ ਜਿਵੇਂ ਕਿ ਪੰਜਾਬ ਵਿੱਚ ਕੁੜੀਆਂ ਗਿੱਧਾ ਅਤੇ ਮੁੰਡੇ ਭੰਗੜੇ ਕਰਦੇ ਹਨ ਹਾਲ ਵਿੱਚ ਬੈਠੇ ਦਰਸ਼ਕ ਗਿੱਧਾ ਭੰਗੜਾ ਕਰਕੇ ਵੇਖ ਬਹੁਤ ਖੁਸ਼ ਅਤੇ ਉਤੇਜਿਤ ਹੁੰਦੇ ਹਨ ਉਹਨਾਂ ਅੰਦਰ ਇੱਕ ਜੋਸ਼ ਆ ਜਾਂਦਾ ਹੈ ਜੋ ਉਹਨਾਂ ਨੂੰ ਬਹੁਤ ਪਸੰਦ ਹੁੰਦਾ ਹੈ ਦਰਸ਼ਕ ਡਾਂਸ ਕਰਦੇ ਹੋਏ ਵੇਖ ਕੇ ਆਪ ਵੀ ਨੱਚਣ ਦੀ ਕੋਸ਼ਿਸ਼ ਕਰਦੇ ਹਨ ਪੰਜਾਬ ਵਿੱਚ ਗਿੱਧਾ ਅਤੇ ਭੰਗੜਾ ਦੇਖ ਕੇ ਦਰਸ਼ਕ ਬਹੁਤ ਖੁਸ਼ ਹੋ ਜਾਂਦੇ ਹਨ